ਜੇਕਰ ਮੈਨੂੰ ਤਸਵੀਰਾਂ ਰਾਹੀਂ ਭਾਰਤ ਨੂੰ ਦਿਖਾਉਣ ਦਾ ਮੌਕਾ ਮਿਲੇ ਤਾਂ ਮੈਂ ਭਾਰਤ ਵਿੱਚ ਬਹੁਤ ਸਾਰੀਆਂ ਹਿਸਟੋਰਿਕਲ ਪਲੇਸਿਸ ਨੂੰ ਦਿਖਾਉਣਾ ਚਾਹਵਾਂਗੀ ਜਿਵੇਂ ਪੰਜਾਬ ਵਿੱਚ ਗੋਲਡਨ ਟੈਂਪਲ ਅਤੇ ਹੋਰ ਵੀ ਕਈ ਕਈ ਸਿਟੀਜ਼ ਵਿੱਚ ਬਹੁਤ ਸਾਰੇ ਮੰਦਰਜ਼ ਜਿਵੇਂ ਪੰ ਪੰਜਾਬ ਦੇ ਪਟਿਆਲਾ ਵਿੱਚ ਹੈਗਾ ਕਾਲੀ ਮਾਤਾ ਮੰਦਰ ਜਾਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਜਾਂ ਮੁੰਬਈ ਵਿੱਚ ਗੇਟਵੇ ਔਫ ਇੰਡੀਆ ਅਤੇ ਆਗਰਾ ਵਿੱਚ ਤਾਜ ਮਹਿਲ ਇਹ ਸਾਰੀਆਂ ਹਿਸਟੋਰੀਕਲ ਪਲੇਸਿਸ ਭਾਰਤ ਦੇ ਭਾਰਤ ਨੂੰ ਦਰਸਾਉਂਦੀਆਂ ਹਨ ਅਤੇ ਹੋਰ ਵੀ ਕਈ ਸਾਰੀਆਂ ਪਲੇਸਿਸ ਹਨ ਜਿਵੇਂ ਕਿ ਜੈਪੁਰ ਸਿਟੀ ਆੱਫ ਫਲਾਵਰਸ ਅਤੇ ਹੋਰ ਵੀ ਕੋਈ ਸਾਰੇ ਕਈ ਸਾਰੇ ਪਲੇਸਿਸ ਹਨ ਜੋ ਕਿ ਦਿਖਾਉਣ ਲਾਇਕ ਹਨ